ਟੈਕਨੋਲਜੀ ਨੇ ਸਾਡੇ ਕਾਰੋਬਾਰਾਂ ਦੇ ਵਿਕਾਸ ਵਿੱਚ ਬਹੁਤ ਮਦਦ ਕੀਤੀ ਆ ਜਿੱਦਾਂ ਕਿ ਸਾਡੇ ਕੋਈ ਕਾਰੋਬਾਰ ਵਾ ਸਾਡੇ ਕੋਲ ਇੱਕ ਦੁਕਾਨ ਆ ਜਿਹਦੇ ਵਿੱਚ ਅਸੀਂ ਹਵਾਈ ਟਿਕਟਾਂ ਰੇਲਵੇ ਟਿਕਟਾਂ ਬੁੱਕ ਕਰਦੇ ਹਾਂ ਅਸੀਂ ਪੈਨ ਕਾਰਡ ਆਧਾਰ ਕਾਰਡ ਵੋਟਰ ਕਾਰਡ ਵੀ ਬਣਾਉਂਦੇ ਹਾਂ ਅਸੀਂ ਟੈਸਟ ਵੀ ਅਪਲਾਈ ਕਰਦੇ ਹਾਂ ਜਿਵੇਂ ਕਿ ਜੇ ਈ ਈ ਐੱਨ ਈ ਈ ਟੀ ਗੇਟਸ ਅਤੇ ਹੋਰ ਕਈ ਤਰ੍ਹਾਂ ਦੇ ਟੈਸਟ ਵੀ ਭਰਦੇ ਹਾਂ ਅਸੀਂ ਪਾਸਪੋਰਟ ਸਾਈਜ਼ ਫੋਟੋਆਂ ਵੀ ਕੱਢਦੇ ਹਾਂ ਸਾਡੀ ਜਿਹੜੀ ਦੁਕਾਨ ਆ ਉਹ ਐਸ ਆਈ ਐਸ ਬੀ ਆਈ ਬੈਂਕ ਦੇ ਨਾਲ ਲਿੰਕ ਆ ਜਿਹਦੇ ਵਿੱਚ ਅਸੀਂ ਬੈਂਕ ਦੇ ਕੰਮ ਵੀ ਕਰਦੇ ਹਾਂ ਅਸੀਂ ਲੋਕਾਂ ਦੇ ਬੈਂਕ ਦੇ ਖਾਤੇ ਵੀ ਖੋਲਦੇ ਹਾਂ ਇਸ ਤਰ੍ਹਾਂ ਸਾਡਾ ਬਹੁਤ ਫ਼ਾਇਦਾ ਹੁੰਦਾ ਹੈ ਅਤੇ ਟੈਕਨੋਲਜੀ ਨੇ ਸਾਡੇ ਕਾਰੋਬਾਰ ਦੇ ਵਿਕਾਸ ਨੂੰ ਇਸ ਤਰ੍ਹਾਂ ਪ੍ਰਭਾਵਿਤ ਕੀਤਾ ਹੈ